ਮੈਂ ਆਪਣੇ ਬਚਪਨ ਤੋਂ ਹੀ ਇਤਿਹਾਸ ਸਿੱਖਣ ਬਾਰੇ ਆਨੰਦ ਮਾਣਿਆ ਹੈ ਅਤੇ ਸ ਮੈਨੂੰ ਇਤਿਹਾਸਕ ਛੋਟਾ ਜਿਹਾ ਇੱਕ ਹਿੱਸਾ ਪਤਾ ਹੈ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਵਜ਼ੀਰ ਖਾਨ ਨੇ ਛੋ ਗੁਰੂ ਦਸਵੇਂ ਗੁਰੂਆਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ ਬਾਬਾ ਫਤਿਹ ਸਿੰਘ ਅਤੇ ਬਾਬਾ ਜ਼ੋਰਾਵਰ ਸਿੰਘ ਜੀ ਨੂੰ ਨੀਹਾਂ ਦੇ ਵਿੱਚ ਚਿਣਵਾ ਦਿੱਤਾ ਸੀ ਅਤੇ ਇਹਨਾਂ ਨੂੰ ਚਿਣਵਾਉਣ ਦਾ ਕਾਰਨ ਇਹ ਸੀ ਕਿ ਉਹਨਾਂ ਨੇ ਵਜ਼ੀਰ ਖਾਨ ਨੇ ਉਹਨਾਂ ਨੂੰ ਉਹਨਾਂ ਦਾ ਧਰਮ ਨੂੰ ਛੱਡਣ ਲਈ ਕਿਹਾ ਸੀ ਪਰ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ ਬਾਬਾ ਫਤਿਹ ਸਿੰਘ ਤੇ ਬਾਬਾ ਜ਼ੋਰਾਵਰ ਸਿੰਘ ਜੀ ਨੇ ਉਹਨਾਂ ਦਾ ਉਹਨਾਂ ਨੂੰ ਇਸ ਇਹ ਲਈ ਕਹਿ ਦਿੱਤਾ ਕਿ ਅਸੀਂ ਆਪਣਾ ਧਰਮ ਨਹੀਂ ਵਾਰ ਸਕਦੇ ਭਾਵੇਂ ਤੁਸੀਂ ਸਾਡੀ ਜਾਨ ਲੈ ਲਵੋ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰਾਂ ਵਜ਼ੀਰ ਖਾਨ ਨੇ ਉਹਨਾਂ ਨੂੰ ਜ਼ਿੰਦਾ ਨੀਹਾਂ ਦੇ ਵਿੱਚ ਚਿਣਵਾ ਦਿੱਤਾ ਸੀ ਤਾਂ ਜੋ ਉਹਨਾਂ ਨੇ ਉਹਨਾਂ ਦਾ ਧਰਮ ਨਹੀਂ ਕਬੂਲਿਆ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰਾਂ ਨੇ ਹੱਸਦੇ ਹੱਸਦੇ ਆਪਣੀਆਂ ਕੁਰਬਾਨੀਆਂ ਦੇ ਦਿੱਤੀਆਂ ਕਿ ਉਹ ਇਹਨਾਂ ਦਾ ਧਰਮ ਨਹੀਂ ਕਬੂਲ ਕਰਨਗੇ ਅਤੇ ਜੇ ਉਹਨਾਂ ਦਾ ਕਿਉਂਕਿ ਉਹਨਾਂ ਦੇ ਦਾਦਾ ਜੀ ਨੇ ਸਿੱਖਾਂ ਦੇ ਕਰਕੇ ਆਪਣਾ ਸਿਰ ਕੱਟਵਾ ਦਿੱਤਾ ਸੀ ਪਰ ਉਹਨਾਂ ਨੇ ਵੀ ਹਾਰ ਨਹੀਂ ਮੰਨੀ ਸੀ ਇਸ ਕਰਕੇ ਹੀ ਗੁ ਉਹਨਾਂ ਨੇ ਆਪਣੇ ਦਾਦਾ ਜੀ ਤੋਂ ਸਿੱਖਿਆ ਲੈਂਦੇ ਹੋਏ ਵੀ ਆਪਣੀ ਜਾਨ ਕੁਰਬਾਨ ਕਰ ਦਿੱਤੀ ਪਰ ਆਪਣਾ ਧਰਮ ਨਹੀਂ ਛੱਡਿਆ ਸੀ